ਹੈਲੋ ਹਾਂਜੀ ਵੀਰ ਜੀ ਤੁਸੀਂ ਗਿੱਦੜਵਾ ਮੁਕਤਸਰ ਤੋਂ ਬੋਲ ਰਹੇ ਹੋ ਅਤੇ ਵੀਰੇ ਮੈਂ ਨਾ ਤੁਹਾਡੇ ਫਰੈਂਡ ਤੋਂ ਤੁਹਾਡਾ ਨੰਬਰ ਲਿਆ ਹੈ ਅਤੇ ਤੁਸੀਂ ਗੁਰੂ ਨਾਨਕ ਕਾਲਜ 'ਚ ਪੜ੍ਹਦੇ ਹੋ ਅਤੇ ਮੈਂ ਨਾ ਤੁਹਾਨੂੰ ਉਸ ਕਾਲਜ ਦੇ ਬਾਰੇ ਪੁੱਛਣਾ ਸੀਗਾ ਵੀ ਉਹ ਕਾਲਜ ਕਿਵੇਂ ਹੈ ਅੱਛਾ ਮੈਂ ਨਾ ਉੱਥੇ ਐਡਮਿਸ਼ਨ ਲੈਣ ਦੀ ਸੋਚ ਰਹੀ ਹਾਂ ਤਾਂ ਮੈਂ ਸੋਚਿਆ ਵੀ ਇੱਕ ਵਾਰ ਤੁਹਾਡੇ ਤੋਂ ਚੰਗੀ ਤਰ੍ਹਾਂ ਪੁੱਛ ਲਵਾਂ ਵੀ ਉਹ ਕਾਲਜ ਕਿਵੇਂ ਹੈ ਅੱਛਾ ਅੱਛਾ ਕੁਆਲੀਫਾਈਡ ਹੈ ਟੀਚਰ ਕਾਫ਼ੀ ਕੁਆਲੀਫਾਈਡ ਹੈ ਅੱਛਾ ਅੱਛਾ ਅੱਛਾ ਅਤੇ ਬਾਕੀ ਉੱਥੇ ਨੇੜੇ ਕੋਈ ਨੇੜੇ ਤੇੜੇ ਕੋਈ ਪੀ ਜੀ ਵਗੈਰਾ ਵੀ ਹੈਗਾ ਅੱਛਾ ਉੱਥੇ ਰਹਿ ਸਕਦੇ ਹਾਂ ਠੀਕ ਹੈ ਅਤੇ ਬਾਕੀ ਉੱਥੇ ਖਾਣਾ ਵਗੈਰਾ ਉਹ ਹੀ ਦਿੰਦੇ ਆ ਕਿ ਕਿ ਤੁਸੀਂ ਉਹ ਵੀ ਉੱਥੇ ਹੀ ਰਹਿੰਦੇ ਹੋ ਪੀ ਜੀ 'ਚ ਅੱਛਾ ਅੱਛਾ ਅੱਛਾ ਅੱਛਾ ਵਧੀਆ ਹੁੰਦਾ ਖਾਣਾ ਸਾਫ਼ ਸੁਥਰਾ ਹੁੰਦਾ ਹੈ ਅੱਛਾ ਅਤੇ ਮੌਸਮ ਵਗੈਰਾ ਕਿਵੇਂ ਇੱਧਰ ਦਾ ਅੱਛਾ ਅਤੇ ਬਾਕੀ ਕੋਈ ਦਿੱਕਤ ਤਾਂ ਨਹੀਂ ਆਉਂਦੀ ਨਾ ਵੀ ਹੈ ਨਾ ਦੂਰ ਦਾ ਹੈਗਾ ਮੇਰਾ ਅੱਛਾ ਅੱਛਾ ਅੱਛਾ ਬਸ ਉਹ ਹੀ ਹੁੰਦਾ ਥੋੜ੍ਹਾ ਜਿਹਾ ਹੈ ਨਾ ਔਖਾ ਨਾ ਲੱਗੇ ਕਿਸੇ ਦੂਜੀ ਜਗ੍ਹਾ 'ਤੇ ਜਾ ਕੇ ਥੋੜ੍ਹਾ ਜਿਹਾ ਮਾਹੌਲ ਵਧੀਆ ਮਿਲ ਜਾਵੇ ਤਾਂ ਸੌਖਾ ਹੋ ਜਾਂਦਾ ਐਡਜਸਟ ਕਰਨਾ ਹੈ ਨਾ ਹਾਂਜੀ ਹਾਂਜੀ ਚਲੋ ਵੀਰ ਜੀ ਥੈਂਕ ਯੂ